ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹੋਰ ਠੀਕ ਠਾਕ ਹਾਂਜੀ ਦੱਸੋ ਅਸੀਂ ਖਰੜ ਤੋਂ ਹਾਂਜੀ ਕਿਸ ਤਰ੍ਹਾਂ ਦਾ ਸੂਟ ਹੈ ਤੁਹਾਡਾ ਮਤਲਬ ਲੈਸਾਂ ਲਾਉਣੀਆਂ ਲਾਈਨਿੰਗ ਵਗੈਰਾ ਕੁਛ ਨਹੀਂ ਹੈ ਅੱਛਾ ਅਤੇ ਸੂਟ ਦੀ ਸਿਲਾਈ ਹੈਗੀ ਹੈ ਅੱਠ ਸੌ ਰੁਪਏ ਲੈਸਾਂ ਵਗੈਰਾ ਲਾ ਕੇ ਲਾਈਨਿੰਗ ਲਾ ਕੇ ਤੁਸੀਂ ਫੜਾ ਜਾਇਓ ਕੋਈ ਗੱਲ ਨਹੀਂ ਬਣਾ ਦਊਂਗੀ ਮੈਂ ਨਾਪ ਦੱਸ ਦਿਓ ਆਪਣਾ ਹਾਂਜੀ ਤੁਸੀਂ ਮੈਨੂੰ ਲਿਖਾ ਦਿਓ ਇਸ ਤਰ੍ਹਾਂ ਤੁਸੀਂ ਮੈਨੂੰ ਲੈਂਥ ਵਗੈਰਾ ਸਾਰਾ ਕੁਛ ਦੱਸ ਦਿਓ ਲੈਂਥ ਦੱਸ ਦਿਓ ਕਿੰਨੀ ਹੈ ਠੀਕ ਹੈ ਫਲੇਅਰ ਘੇਰਾ ਠੀਕ ਹੈ ਤੀਰਾ ਠੀਕ ਹੈ ਜੀ ਅਤੇ ਚੈਸਟ ਠੀਕ ਹੈ ਕਮਰ ਚੱਲੋ ਠੀਕ ਹੈ ਫਿਰ ਤੁਸੀਂ ਮੈਨੂੰ ਕੱਲ੍ਹ ਫੜਾ ਜਾਇਓ ਜਦ ਮਰਜ਼ੀ ਫੜਾ ਜਾਇਓ ਮੈਂ ਬਣਾ ਦੂੰਗੀ ਠੀਕ ਹੈ ਜੀ ਹਾਂਜੀ ਉਹ ਮਤਲਬ ਤੁਹਾਨੂੰ ਕਿੰਨੇ ਦਿਨ ਤੱਕ ਚਾਹੀਦਾ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਮੈਂ ਬਣਾ ਦਊਂਗੀ ਠੀਕ ਹੈ ਜੀ ਠੀਕ ਹੈ ਫੜਾ ਜਾਇਓ ਕੋਈ ਗੱਲ ਨਹੀਂ ਠੀਕ ਹੈ ਜੀ